ਪੇਂਡੂ ਖੇਤੀਬਾੜੀ ਵਿੱਚ ਹੁਨਰਮੰਦ ਕਿਰਤੀਆਂ ਨੂੰ ਲੱਭਣ ਅਤੇ ਉਹਨਾਂ ਨੂੰ ਕਾਇਮ ਰੱਖਣ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਹਨਾਂ ਨੂੰ ਜ਼ਿਆਦਾਤਰ ਖੇਤੀਬਾੜੀ ਦੀ ਨੌਲਜ ਨਹੀਂ ਹੁੰਦੀ ਹੈਗੀ ਉਹਨਾਂ ਨੂੰ ਇਨ੍ਹਾਂ ਐਗਰੀਕਚਲਰ ਨੂੰ ਉਹਨਾਂ ਦੀਆਂ ਮੀਟਿੰਗਾਂ ਕਰਨੀਆਂ ਚਾਹੀਦੀਆਂ ਉਹਨਾਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਕਿਸ ਮੌਸਮ ਵਿੱਚ ਕਿਹੜਾ ਬੀਜ ਲੱਗਣਾ ਹੈ ਉਹਨੂੰ ਕਿਸ ਟਾਈਮ ਪਾਣੀ ਦੀ ਜ਼ਰੂਰਤ ਹੈ ਉਸ ਨੂੰ ਕਿਸ ਟਾਈਮ ਰੇਹ ਦੀ ਜ਼ੂਰਰਤ ਹੈ ਇਹ ਸਾਰਾ ਕੁਛ ਇਹਨਾਂ ਨੂੰ ਸਮਝਾਉਣ ਦੀ ਲੋੜ ਹੈ ਔਰ ਟਾਈਮ ਟਾਈਮ ਨਾਲ ਇਹਨਾਂ ਦੀਆਂ ਮੀਟਿੰਗਾਂ ਹੋਣੀਆਂ ਚਾਹੀਦੀਆਂ ਹੈ ਤਾਂ ਜੋ ਇਹਨਾ ਨੂੰ ਕਿਰਤੀਆਂ ਹੁਨਰਮੰਦ ਕਿਰਤੀਆਂ ਨੂੰ ਲੱਭਣ ਅਤੇ ਕੰਮ ਵਿੱਚ ਰੱਖਣ ਵਿੱਚ ਕੋਈ ਚੁਣੌਤੀਆਂ ਦਾ ਸਾਹਮਣਾ ਨਾ ਕਰਨਾ ਪਵੇ ਅੱਜ ਕੱਲ੍ਹ ਦਿਹਾੜੀਦਾਰ ਕਾਮਿਆਂ ਦੀ ਮੌਜੂਦਾ ਤਨਖਾਹ ਚਾਰ ਸੌ ਰੁਪਿਆ ਦਿਹਾੜੀ ਹੈ